ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡੇ ਆਓ ਜੀ ਤੁਸੀਂ ਬਠਿੰਡੇ ਬਠਿੰਡੇ ਘੁੰਮਣ ਵਾਲੀਆਂ ਜਗ੍ਹਾ ਬਹੁਤ ਹੈ ਦੇਖਣ ਵਾਲੀ ਜਗ੍ਹਾ ਬਹੁਤ ਹੈ ਉੱਥੇ ਚਾਰ ਪੰਜ ਦਿਨ ਲੱਗ ਜਾਣਗੇ ਜੀ ਤੁਹਾਨੂੰ ਸਾਰੇ ਆਉਣ ਜਾਣ ਦੇ ਆਪਣਾ ਦੇਖਣ ਦੇ ਕਰਨ ਦੇ ਕਿਉਂਕਿ ਬਠਿੰਡੇ ਇੱਕ ਤਾਂ ਮੌਲ ਹੈ ਬਹੁਤ ਮੋਲ ਦੇਖਣ ਵਾਲੇ ਆ ਬਹੁਤ ਹਰ ਸਮਾਨ ਤੇ ਜੋ ਵੀ ਲੈਣਾ ਮੋਲ ਬਹੁਤ ਤਕੜੇ ਬਣਾਏ ਹੋਏ ਆ ਚੰਗੇ ਮੋਲ ਦੂਸਰਾ ਇੱਥੇ ਪਾਰਕ ਹੈ ਦਾਦੀ ਪੋਤੀ ਪਾਰਕ ਹੈ ਉਹ ਵੀ ਘੁੰਮਣ ਫਿਰਨ ਨੂੰ ਬਹੁਤ ਵਧੀਆ ਹੈ ਇੱਕ ਪਾਰਕ ਆਪਣਾ ਰੋਜ ਗਾਰਡਨ ਹੈ ਜੋ ਕਿ ਆਪਣੇ ਨਹਿਰ ਦੇ ਨਜ਼ਦੀਕ ਉੱਥੇ ਵੀ ਤੁਸੀਂ ਘੁੰਮ ਸਕਦ ਸਕਦੇ ਹੋ ਇਸ ਤਰ੍ਹਾਂ ਕਰਕੇ ਇੱਥੇ ਬਹੁਤ ਹੀ ਦੇਖਣ ਯੋਗ ਚੀਜ਼ਾਂ ਹਨ ਹਰ ਜਗ੍ਹਾ ਜਾ ਕੇ ਦੇਖਣ ਵਾਸਤੇ ਜਿਵੇਂ ਇੱਥੇ ਬਹੁਤ ਪੁਰਾਤਨ ਸਮੇਂ ਦਾ ਕਿਲ੍ਹਾ ਹੈ ਬਠਿੰਡੇ ਅਤੇ ਉਹ ਬਠਿੰਡੇ ਦਾ ਕਿਲ੍ਹਾ ਦੇਖਣ ਵਾਲਾ ਹੈ ਬਹੁਤ ਵਧੀਆ ਕਿਲ੍ਹਾ ਬਣਿਆ ਹੈ ਹੁਣ ਉਹਨਾਂ ਦੀ ਮੁਰੰਮਤ ਵਗੈਰਾ ਹੋ ਰਹੀ ਹੈ ਲੋਕ ਬਹੁਤ ਦੂਰੋਂ ਦੂਰੋਂ ਇਹ ਦੇਖਣ ਆਉਂਦੇ ਹੈ ਕਿਲ੍ਹਾ ਅਤੇ ਬਾਕੀ ਜੋ ਕੰਪਲੈਕਸ ਬਣੇ ਹੋਏ ਆ ਉਹ ਬਾਕੀ ਰੋਡ ਜਿੰਨਾ ਵੀ ਹੈ ਨਵੇਂ ਬਣੇ ਹੋਏ ਆ ਅਤੇ ਸਾਰੇ ਦੇਖਣਯੋਗ ਹੈ ਜੀ ਇੱਥੇ ਪਰ ਇਹ ਇਹ ਖਰਕਾ ਖਰਚਾ ਭਾਈ ਪੰਜ ਹਜ਼ਾਰ ਤੋਂ ਉੱਤੇ ਉੱਤੇ ਆਊਗਾ ਤੁਹਾਡਾ ਪੰਜ ਹਜ਼ਾਰ ਤੋਂ ਦੇਖਣ ਦੇਖਣ ਦਾ ਹਾਂ ਫਿਰ ਸਾਧਨ ਲਈ ਤੁਹਾਨੂੰ ਮੈਂ ਇੱਥੋਂ ਕਰਾਕੇ ਦੇ ਸਕਦੇ ਹਾਂ ਅਸੀਂ ਹਾਂ ਜਿਹਦੇ 'ਤੇ ਖਰਚਾ ਬਹੁਤ ਆਊਗਾ ਤੁਹਾਡਾ ਸਾਧਨ ਪੈ ਗਿਆ ਆਪਣੇ ਸਾਧਨ ਲਿਆਉਣ 'ਤੇ ਚੰਡੀਗੜ ਦੇਖਣ ਵਾਸਤੇ ਹਾਂ ਹੋਰ ਬਹੁਤ ਨਾਲੇ ਘੁੰਮ ਘੰਮ ਕੇ ਵੇਖਣਾ ਹਾਂ ਭਾਈ ਸਾ